ਚੁੱਲ੍ਹੇ 'ਤੇ ਅਸੀਂ ਸਰਸੋਂ ਦਾ ਸਾਗ ਬਣਾਉਂਦੇ ਹਨ ਅਤੇ ਮੱਕੀ ਦੀ ਰੋਟੀ ਬਣਾਉਂਦੇ ਹਾਂ ਜੋ ਕਿ ਬਹੁਤ ਵਧੀਆ ਬਣਦੀ ਹੈ ਗੈਸ 'ਤੇ ਅਸੀਂ ਮੈਗੀ ਜਾਂ ਕੋਈ ਸਬਜ਼ੀ ਬਣਾ ਲੈਂਦੇ ਹਨ ਜੋ ਕਿ ਸਵਾਦ ਵੀ ਬਣਦੀ ਹੈ ਪਰ ਜੇਕਰ ਅਸੀਂ ਸਰਸੋਂ ਦਾ ਸਾਗ ਗੈਸ 'ਤੇ ਬਣਾਉਂਦੇ ਹਾਂ ਤਾਂ ਉਹ ਇੰਨਾ ਖਾਸ ਇੰਨਾ ਸਵਾਦ ਨਹੀਂ ਬਣਦਾ ਜਿੰਨਾ ਚੁੱਲ੍ਹੇ 'ਤੇ ਬਣਦਾ ਹੈ ਮੱਕੀ ਦੀ ਰੋਟੀ ਨੂੰ ਖਾਣ ਦਾ ਬਣਾਉਣ ਦਾ ਤਰੀਕਾ ਸਭ ਤੋਂ ਬੈਸਟ ਵਧੀਆ ਚੁੱਲ੍ਹਾ ਹੀ ਮੰਨਿਆ ਗਿਆ ਹੈ